ਹਾਂ ਮੈਂ ਆਪਣੀ ਯੂਨੀਵਰਸਿਟੀ ਸਮੇਂ ਵਿੱਚ ਗਿੱਧਾ ਡਾਂਸ ਕੀਤਾ ਸੀ ਗਿੱਧੇ ਦੇ ਮੁਕਾਬਲੇ ਵਿੱਚ ਮੇਰਾ ਐਕਸਪੀਰੀਅਂਸ ਬਹੁਤ ਹੀ ਵਧੀਆ ਸੀ ਮੈਂ ਗਿੱਧਾ ਨਾਚ ਬਾਰੇ ਆਪਣਾ ਅਨੁਭਵ ਸਾਂਝਾ ਕਰਨਾ ਚਾਹੁੰਦੀ ਹਾਂ ਗਿੱਧਾ ਨਾਚ ਪੰਜਾਬੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ ਇਹ ਨਾਚ ਮਹਿਲਾ ਨੂੰ ਰੰਗੀਨ ਕੱਪੜੇ ਪਾ ਕੇ ਅਤੇ ਗਾਣੇ ਨਾਲ ਖੇਡਣ ਦੀ ਆਜ਼ਾਦੀ ਦਿੰਦਾ ਹੈ ਮੈਂ ਗਿੱਧਾ ਨੱਚਦੇ ਸਮੇਂ ਖੁਸ਼ੀ ਅਤੇ ਉਤਸ਼ਾਹ ਮਹਿਸੂਸ ਕਰਦੀ ਹਾਂ ਨੱਚਦੇ ਦੌਰਾਨ ਮੈਨੂੰ ਲੱਗਦਾ ਹੈ ਮੈਂ ਆਪਣੇ ਸੱਭਿਆਚਾਰ ਨਾਲ ਜੁੜੀ ਹੋਈ ਹਾਂ ਸਾਰ ਵਿੱਚ ਗਿੱਧਾ ਨਾਚ ਇੱਕ ਮਨੋਰੰਜਕ ਅਤੇ ਸੰਸਕ੍ਰਿਤਿਕ ਅਨੁਭਵ ਹੈ ਇਹ ਮੈਨੂੰ ਅੰਦਰੂਨੀ ਖੁਸ਼ੀ ਪ੍ਰਦਾਨ ਕਰਦਾ ਹੈ ਮੈਂ ਆਪਣੇ ਪਰਿਵਾਰਕ ਵਿਆਹਾਂ ਵਿੱਚ ਵੀ ਗਿੱਧਾ ਕਰਨਾ ਪਸੰਦ ਕਰਦੀ ਹਾਂ ਅਤੇ ਆਪਣੀ ਛੋਟੀਆਂ ਭੈਣਾ ਨੂੰ ਵੀ ਇਹ ਕਰਨ ਲਈ ਕਹਿੰਦੀ ਹਾਂ ਅਤੇ ਉਹ ਵੀ ਇਸ ਨੂੰ ਗਿੱਧੇ ਵਿੱਚ ਨੱਚ ਕੇ ਖੁਸ਼ੀ ਮਹਿਸੂਸ ਕਰਦੀਆਂ ਹਨ